ਤਿੰਨ ਚਾਰ ਦੋ ਹਜ਼ਾਰ ਚਾਰ ਸੱਤ ਇੱਕ ਦੋ ਹਜ਼ਾਰ ਤੇਈ ਅੱਠ ਦਸ ਦੋ ਹਜ਼ਾਰ ਇੱਕੀ ਨੌ ਦਸ ਦੋ ਹਜ਼ਾਰ ਛੇ ਅੱਠ ਦੋ ਹਜ਼ਾਰ ਇੱਕ